ਸਤਾਰ੍ਹਾਂ ਅਗਸਤ ਉੱਨੀ ਸੌ ਨੱਬੇ ਪੰਜ ਨਵੰਬਰ ਦੋ ਹਜ਼ਾਰ ਸੱਤ ਛੱਬੀ ਜਨਵਰੀ ਸਤਾਰ੍ਹਾਂ ਸੌ ਪੰਜਾਹ ਵੀਹ ਮਾਰਚ ਦੋ ਹਜ਼ਾਰ ਸਤਾਰ੍ਹਾਂ ਦਸ ਫਰਵਰੀ ਦੋ ਹਜ਼ਾਰ ਤੇਈ